ਛੱਬੀ ਅਪ੍ਰੈਲ ਉੱਨੀ ਸੌ ਸਤਾਸੀ ਬਾਈ ਅਕਤੂਬਰ ਉੱਨੀ ਸੌ ਛਿਆਸੀ ਸੋਲ੍ਹਾਂ ਜੁਲਾਈ ਦੋ ਹਜ਼ਾਰ ਗਿਆਰ੍ਹਾਂ ਸੋਲ੍ਹਾਂ ਨਵੰਬਰ ਦੋ ਹਜ਼ਾਰ ਪੰਦਰ੍ਹਾਂ ਅਠਾਈ ਸਤੰਬਰ ਦੋ ਹਜ਼ਾਰ ਇੱਕੀ